ਅੱਜ ਦੇ ਲੋਕ ਵੈਸੇ ਵੈਸਟਰਨ ਡਾਂਸ ਹੀ ਪਸੰਦ ਕਰਦੇ ਹਨ ਪਰ ਮੈਨੂੰ ਪੰਜਾਬੀ ਡਾਂਸ ਪਸੰਦ ਹੈ ਕਿਉਂਕਿ ਪੰਜਾਬੀ ਡਾਂਸ ਵਿੱਚ ਗਿੱਧਾ ਭੰਗੜਾ ਆਦਿ ਹੁੰਦਾ ਹੈਗਾ ਅਤੇ ਲੋਕ ਆਪਣੇ ਆਪ ਬੋਲੀਆਂ ਪਾਉਂਦੇ ਭੰਗੜੇ ਪਾਉਂਦੇ ਗਿੱਧਾ ਪਾਉਂਦੇ ਅਤੇ ਹੁਣ ਦੇ ਲੋਕ ਇੱਕ ਥਾਂ 'ਤੇ ਹੀ ਮਿਊਜਿਕ ਪਲੇਅ ਕਰ ਦਿੰਦੇ ਹੈ ਅਤੇ ਨੱਚਣ ਲੱਗ ਜਾਂਦੇ ਹੈ ਇਸ ਲਈ ਮੈਨੂੰ ਇਹ ਇੰਨਾ ਪਸੰਦ ਨਹੀਂ ਹੈ ਮੈਨੂੰ ਜ਼ਿਆਦਾ ਪੰਜਾਬੀ ਡਾਂਸ ਪਸੰਦ ਹੈ ਪਰ ਜਿਹੜੇ ਹੁਣ ਦੇ ਲੋਕ ਨੇ ਬੱਚੇ ਨੇ ਸੋਸ਼ਲ ਮੀਡੀਆ 'ਤੇ ਦੇਖ ਦੇਖ ਕੇ ਉਹ ਵੈਸਟਰਨ ਡਾਂਸ ਹੀ ਚੂਜ਼ ਕਰਦੇ ਨੇ ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਪੰਜਾਬੀ ਡਾਂਸ ਇੰਨਾ ਜ਼ਿਆਦਾ ਵਧੀਆ ਹੈ ਕਿ ਬੱਚੇ ਆਪਸ ਵਿੱਚ ਨੱਚਦੇ ਮਖੌਲ ਕਰਦੇ ਆਪ ਹੀ ਗਾਉਂਦੇ ਬਹੁਤ ਵਧੀਆ ਫੀਲ ਹੁੰਦਾ ਹੈਗਾ ਜਦੋਂ ਇੱਦਾਂ ਦਾ ਹੁੰਦਾ ਹੈਗਾ ਪਰ ਲੋਕ ਵੈਸਟਰਨ ਡਾਂਸ ਹੀ ਪਸੰਦ ਕਰ ਰਹੇ ਹਨ ਬਾਕੀ ਸਭ ਦੀ ਆਪਣੀ ਚੋਆਇਸ ਹੁੰਦੀ ਹੈ